ਹੈਲੋ ਸਤਿ ਸ਼੍ਰੀ ਅਕਾਲ ਸਰ ਜੀ

ਰਾਈਟ ਸਰ ਕੁਲਦੀਪਕ ਜੀ ਵੈਲਕਮ ਫਸਟ ਔਫ ਅੋਲ ਤੁਹਾਡਾ ਜੀ ਕਪੂਰਥਲਾ ਸਿਟੀ ਵਿੱਚ ਅਤੇ ਕਪੂਰਥਲਾ ਸਰ ਇੱਕ ਇੱਕ ਵਿਰਾਸਤੀ ਸ਼ਹਿਰ ਹੈ ਰਾਜਿਆਂ ਮਹਾਰਾਜਿਆਂ ਦਾ ਸ਼ਹਿਰ ਹੈ ਅਤੇ ਸਾਡੇ ਸਰ ਕਪੂਰਥਲੇ ਵਿੱਚ ਮਤਲਬ ਬੜੇ ਇੱਦਾਂ ਦੇ ਪਲੇਸਿਸ ਹੈਗੀਆਂ ਹੈ ਜਿੱਦਾਂ ਸਟੇਟ ਗੁਰਦੁਆਰਾ ਸਾਹਿਬ ਹੈ ਮਤਲਬ ਬੜਾ ਫੇਮਸ ਗੁਰਦੁਆਰਾ ਸਾਹਿਬ ਕਪੂਰਥਲੇ ਦਾ ਅਤੇ ਇੱਥੇ ਸੈਨਿਕ ਸਕੂਲ ਆ ਸਰ ਪੂਰੇ ਪੰਜਾਬ ਦਾ ਇੱਕੋ ਇੱਕ ਜਿੱਦਾਂ ਹਰ ਸਟੇਟ ਵਿੱਚ ਇੱਕ ਸੈਨਿਕ ਸਕੂਲ ਆ ਅਤੇ ਪੰਜਾਬ ਦਾ ਸੈਨਿਕ ਸਕੂਲ ਸਾਡੇ ਕਪੂਰਥਲਾ ਵਿੱਚ ਹੈ ਅਤੇ ਇੱਕ ਮੋਸਕ ਹੈਗੀ ਸਰ ਇੱਥੇ ਮਸਜ਼ਿਦ ਹੈ ਫਿਰ ਇੱਥੇ ਰਾਣੀ ਮਾਤਾ ਦਾ ਮੰਦਰ ਹੈ ਪੰਚ ਮੰਦਰ ਹੈ ਉਸ ਤੋਂ ਬਾਅਦ ਸਰ ਇੱਥੇ ਸ਼ਾਲੀਮਾਰ ਬਾਗ਼ ਹੈ ਹਾਂਜੀ ਸਰ ਸਰ ਮੈਂ ਤੁਹਾਨੂੰ ਸਾਰੀ ਜਗ੍ਹਾ 'ਤੇ ਵਿਜ਼ਿਟ ਕਰਾਵਾਂਗਾ ਘੁਮਾਵਾਂਗਾ ਇੱਥੇ ਭੱਦਰਕਾਲੀ ਮਾਤਾ ਦਾ ਮੰਦਰ ਮਤਲਬ ਜਿਹੜੀ ਮੈੈਂ ਇੱਥੇ ਫੇਮਸ ਪਲੇਸਿਸ ਹੈ ਮੈਂ ਤੁਹਾਨੂੰ ਸਾਰੀ ਜਗ੍ਹਾ 'ਤੇ ਲੈ ਕੇ ਜਾਉਂਗਾ ਉੱਥੇ ਜਾ ਕੇ ਤੁਹਾਨੂੰ ਘਮਾਉਂਗਾ ਉਹਨਾਂ ਦੀ ਸਾਰੀ ਹਿਸਟਰੀ ਬਾਰੇ ਦੱਸੁਗਾ ਅਤੇ ਤੁਸੀਂ ਆਪਣਾ ਮੈਨੂੰ ਸਰ ਏ ਸ਼ੇਖੂਪੁਰ ਹੈ ਜੀ ਸ਼ੇਖੂਪੁਰ ਹਾਂਜੀ ਹਾਂਜੀ ਸਰ ਸਾਰੀਆਂ ਪਲੇਸਿਸ ਮੈਂ ਤੁਹਾਨੂੰ ਘਮਾਉਂਗਾ ਸੁਲਤਾਨਪੁਰ ਬੇਰ ਸਾਹਿਬ ਤੁਹਾਨੂੰ ਲੈ ਕੇ ਜਾਉਂਗਾ ਕਪੂਰਥਲੇ 'ਚ ਪੈਂਦਾ ਏ ਤੁਸੀਂ ਆਪਣਾ ਮੈਨੂੰ ਰੈਫਰੈਂਸ ਦੇ ਦਿਓ ਸਾਰਾ ਕੁਛ ਐਡਰੈਸ ਦੱਸ ਦਿਓ ਮੈਂ ਤੁਹਾਨੂੰ ਪਿਕ ਡਰੋਪ ਕਰਕੇ ਤੈਅ ਕਰਦੁੰਗਾ ਰਾਈਟ ਸਰ ਥੈਂਕ ਯੂ ਜੀ ਥੈਂਕ ਯੂ